ਮੈਂ ਮੇਰਾ ਨਾਂ ਰਾਗਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਜੇਕਰ ਗੱਲ ਕਰੀਏ ਕਿ ਪੰਜਾਬ ਵਿੱਚ ਸੰਭਾਲ ਹੌਸਪੀਟਲ ਵਧਾਉਣੇ ਚਾਹੇ ਸੰਭਾਲ ਨੂੰ ਉਤਸਾਹ ਦੇਣਾ ਚਾਹੀਦਾ ਹੈ ਤਾਂ ਸਾਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਹੌਸਪੀਟਲ ਖੋਲ੍ਹੇ ਜਾਣ ਮੈਂ ਦੇਖਦਾ ਹਾਂ ਕਿ ਕਈਆਂ ਹੌਸਪੀਟਲਾਂ ਵਿੱਚ ਸਫਾਈ ਨਹੀਂ ਹੁੰਦੀ ਤਾਂ ਅਤੇ ਸਰਕਾਰ ਨੂੰ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਅ ਸਕਣ ਸਾ ਸਰਕਾਰ ਨੂੰ ਕਈ ਕਰਮਚਾਰੀ ਰੱਖਣੇ ਚਾਹੀਦੇ ਹਨ ਜੋ ਸਫਾਈ ਵਿੱਚ ਧਿਆਨ ਦੇਵਣ ਅਤੇ ਕਈ ਜਗ੍ਹਾ 'ਤੇ ਵਧੀਆ ਕਰਕੇ ਸਫਾਈ ਕਰਨ ਜਿੱਥੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਕਈ ਕਈ ਪਿੰਡਾਂ ਵਿੱਚ ਅਜੇ ਤੱਕ ਹੌਸਪੀਟਲ ਨਹੀਂ ਬਣੇ ਉੱਥੇ ਹੋਸਪਿਟਲ ਬਣਾਉਣੇ ਚਾਹੀਦੇ ਹਨ ਅਤੇ ਘੱਟ ਤੋਂ ਘੱਟ ਰੇਟ 'ਤੇ ਉਹਨਾਂ ਮਰੀਜ਼ਾਂ ਦਾ ਇਲਾਜ ਕਰਨਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਜਗ੍ਹਾ ਜਗ੍ਹਾ ਜਗ੍ਹਾ 'ਤੇ ਦਵਾਈਆਂ ਦਾ ਮੈਡੀਕਲ ਸਟੋਰ ਖੋਲ੍ਹਿਆ ਜਾਵੇ ਤਾਂ ਕਿ ਸਾਰਿਆਂ ਨੂੰ ਦਵਾਈਆਂ ਆਰਾਮ ਨਾਲ ਮਿਲ ਜਾਣ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਕਈ ਵਾਰੀ ਡਾਕਟਰ ਉਪਲਬਧ ਨਹੀਂ ਹੁੰਦੇ ਹੋਸਪੀਟਲਾਂ ਵਿੱਚ ਤਾਂ ਸਰਕਾਰ ਨੂੰ ਇਹਦੇ 'ਤੇ ਵੀ ਸਖਤੀ ਕਰਨੀ ਚਾਹੀਦੀ ਹੈ ਅਤੇ ਡਾਕਟਰਾਂ ਨੂੰ ਇੱਕ ਮੌਜੂਦਾ ਟਾਈਮ ਵਿੱਚ ਰੱਖਣਾ ਚਾਹੀਦਾ ਹੈ ਕਈ ਵਾਰੀ ਰਾਤ ਨੂੰ ਐਮਰਜੈਂਸੀ ਵਿੱਚ ਡਾਕਟਰ ਉਪਲਬਧ ਨਹੀਂ ਹੁੰਦੇ ਇਸ ਕਰਕੇ ਸਰਕਾਰ ਨੂੰ ਡਾਕਟਰਾਂ 'ਤੇ ਸਖਤੀ ਕਰਨੀ ਚਾਹੀਦੀ ਹੈ ਅਤੇ ਸਵੇਰ ਦਾ ਟਾਈਮ ਕੁਝ ਡਾਕਟਰ ਅਤੇ ਰਾਤ ਦੇ ਸਮੇਂ ਅਲੱਗ ਡਾਕਟਰਾਂ ਨੂੰ ਹੌਸਪੀਟਲ ਵਿੱਚ ਰਹਿਣਾ ਚਾਹੀਦਾ ਹੈ